ਹਾਂ ਮੈਂ ਆਪਣੇ ਇੰਟਰਨੈਟ ਕਨੈਕਸ਼ਨ ਨੂੰ ਸੁਰੱਖਿਅਤ ਕਰਨ ਅਤੇ ਆਨਲਾਈਨ ਗੋਪੀਨਿਕਤਾ ਦੀ ਰੱਖਿਆ ਕਰਨ ਲਈ ਵਰਚੂਅਲ ਪ੍ਰਾਈਵੇਟ ਨੈਟਵਰਕ ਦੀ ਵਰਤੋਂ ਕੀਤੀ ਹੈ ਇਸ ਸੇਵਾ ਨੂੰ ਵਰਤਣ ਨਾਲ ਮੇਰੇ ਅਨੁਭਵ ਨੇ ਕਾਫ਼ੀ ਫ਼ਾਇਦਾ ਦਿੱਤਾ ਹੈ ਖ਼ਾਸ ਕਰਕੇ ਜਦੋਂ ਮੈਂ ਪਬਲਿਕ ਵਾਈਫਾਈ ਨੈਟਵਰਕਾਂ ਜਾਂ ਹੋਟਲਾਂ ਦੇ ਕੈਫੇ ਵਿੱਚ ਇੰਟਰਨੈਟ ਵਰਤਤਾਂ ਹਾਂ ਜਿੱਥੇ ਸੁਰੱਖਿਅਤ ਕਨੈਕਸ਼ਨ ਦੀ ਭਰੋਸਾਯੋਗਤਾ ਥੋੜ੍ਹੀ ਘੱਟ ਹੁੰਦੀ ਹੈ ਵੀ ਪੀ ਐਨ ਸੇਵਾ ਦੀ ਵਰਤੋ ਨਾਲ ਮੇਰੇ ਡਾਂਟਾਂ ਦਾ ਇਨ ਇਨਕ੍ਰਿਪਸ਼ਨ ਡਾਟਾ ਦਾ ਇਨਕ੍ਰਿਪਸ਼ਨ ਹੋ ਜਾਂਦਾ ਹੈ ਜਿਸ ਨਾਲ ਇਹ ਜ਼ਿਆਦਾ ਸੁਰੱਖਿਅਤ ਬਣ ਜਾਂਦਾ ਹੈ ਇਹ ਆਪਣੇ ਡਾਟਾ ਨੂੰ ਕਿ ਇਹ ਆਪਣੇ ਡਾਟਾ ਨੂੰ ਕਿਉਂਕਿ ਕਿਸੇ ਵੀ ਤਰੀਕੇ ਨਾਲ ਤੀਸਰੇ ਪਾਰਟੀ ਦੁਆਰਾ ਚੋਰੀ ਕਰਨ ਜਾਂ ਹਾਸਿਲ ਕਰਨ ਤੋਂ ਬਚਾਉਂਦਾ ਹੈ ਇਸ ਨਾਲ ਮੇਰੀ ਗੋਪੀਨਿਕਤਾ ਵੀ ਸੁਰਖਿਅਤ ਰਹਿੰਦੀ ਹੈ ਖ਼ਾਸ ਕਰਕੇ ਜਦੋਂ ਮੈਂ ਸਿਸਟਮ ਜਾਂ ਐਪਸ ਜਾਂ ਸਥਾਨ ਜਾਂ ਬਹੂਤਿਨ ਡਾਟਾ ਲਕਾ ਲੁਕਾਉਣਾ ਚਾਹੁੰਦਾ ਹਾਂ ਇਸ ਸੇਵਾ ਦੇ ਨਾਲ ਕੁਝ ਖ਼ਾਸ ਤਰ੍ਹਾਂ ਦੇ ਫ਼ਾਇਦੇ ਹਨ ਜਿਵੇਂ ਕਿ ਜਨਰਲ ਐਨ ਲਾਈਨ ਸੁਰੱਖਿਅਤ ਅਤੇ ਜਿਵੇਂ ਆਨਲਾਈਨ ਅਤੇ ਅਤੇ ਜ਼ਿਆਦਾ ਦੇ ਸਰਵਿਸ ਸੈਟਿੰਗ ਨੂੰ ਹਾਸਲ ਕਰਨਾ ਹੈ ਜਦੋਂ ਮੈਂ ਵੀ ਭਿੰਨ ਭਿੰਨ ਸਥਾਨਾਂ 'ਤੇ ਆਨਲਾਈਨ ਹੋਣ ਦੀ ਕੋਸ਼ਿਸ਼ ਕਰਦਾ ਹਾਂ ਮੈਂ ਆਪਣੇ ਵੀ ਪੀ ਐਨ ਕਨੈਕਸ਼ਨ ਨੂੰ ਅਨੇਬਲ ਕਰਦਾ ਹਾਂ ਤਾਂ ਜੋ ਮੈਂ ਆਪਣੇ ਜੋ ਤਾਂ ਜੋ ਮੇਰੇ ਪਤੇ ਅਤੇ ਪਤੇ ਹੋਣ ਦੀ ਜਾਣਕਾਰੀ ਨੂੰ ਜਗ੍ਹਾ ਅਤੇ ਦੂਜੇ ਸਥਾਨ ਦੀ ਐਡੇ ਐਡਰੈਸ ਵੀ ਛੁਪਾਇਆ ਜਾ ਸਕੇ ਪਰ ਕੁਝ ਗੱਲ ਕੁਝ ਹਲਾਤਾਂ ਵਿੱਚ ਵੀ ਵੀ ਪੀ ਐਨ ਸੇਵਾ ਵੀ ਸੇਵਾ ਵਰਤੋਂ ਅਸੁਵਿਧਾ ਨਾਥ ਹੈ ਜੋ ਹੋ ਸਕਦੀ ਹੈ ਜਿਵੇਂ ਕਿ ਕੁਝ ਸਾਈਟਾਂ ਜਾਂ ਐਪਲੀਕੇਸ਼ਨ ਨੂੰ ਵੀ ਪੀ ਐਨ ਕਨੈਕਸ਼ਨ ਦਾ ਪਤਾ ਲੱਗ ਜਾਂਦਾ ਹੈ ਜਿਸ ਨਾਲ ਸੇਵਾ ਰੁਕ ਜਾਂਦੀ ਹੈ ਇਸ ਲਈ ਕੁਝ ਵੀ ਪੀ ਐਨ ਸੇਵਾ ਦੀ ਕਮਜ਼ੋਰੀ ਵੀ ਹੈ ਹੋ ਸਕਦੀ ਹੈ ਇਹ ਜਦੋਂ ਉਹਨਾਂ ਦੇ ਸਰਵਰ ਸਥਾਨ ਨੂੰ ਬਲੋਕ ਕੀਤਾ ਜਾਂਦਾ ਹੈ ਧੰਨਵਾਦ